ਅੱਜ ਕੱਲ੍ਹ ਪਾਣੀ ਨੂੰ ਫਿਲਟਰ ਕਰਨ ਲਈ ਬਹੁਤ ਸਾਰੀਆਂ ਮਸ਼ੀਨਾਂ ਚੱਲ ਪਈਆਂ ਹਨ ਪਾਣੀ ਫਿਲਟਰ ਕਰਨ ਵਾਲੀਆਂ ਮਸ਼ੀਨਾਂ ਇੰਨੀਆਂ ਵਧੀਆ ਚੱਲਦੀਆਂ ਚੱਲ ਰਹੀਆਂ ਕਿ ਪਾਣੀ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਫਿਲਟਰ ਆਰੋ ਚੱਲ ਰਹੇ ਹਨ ਕੋਪਰ ਵਾਲੇ ਫਿਲਟਰ ਆ ਰਹੇ ਆ ਜਿਹਦੇ ਨਾਲ ਪਾਣੀ ਸਾਨੂੰ ਸ਼ੁੱਧ ਮਿਲਦਾ ਹੈ ਪਰ ਇਹ ਮਸ਼ੀਨਾਂ ਜਾਂ ਇਸ ਤਰ੍ਹਾਂ ਦੇ ਪ੍ਰੋ ਅ ਪ੍ਰੋਡਕਟ ਆ ਜੋ ਹੈ ਇਸ ਹਰ ਇੱਕ ਲੋਕਾਂ ਦੇ ਲਈ ਖਰੀਦਣਾ ਆਮ ਗੱਲ ਨਹੀਂ ਹੈਗੇ ਇਸ ਲਈ ਸਾਨੂੰ ਕੁਝ ਘਰੇਲੂ ਚੀਜ਼ਾਂ ਨਾਲ ਪਾਣੀ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਜਿਵੇਂ ਕਿ ਆਪਾਂ ਸਭ ਤੋਂ ਸੌਖਾ ਤਰੀਕਾ ਇਹੀ ਹੁੰਦਾ ਹੈ ਕਿ ਪਾਣੀ ਨੂੰ ਉਬਾਲ ਲਿੱਤਾ ਜਾਂਦਾ ਹੈ ਉਬਾਲ ਕੇ ਉਸਨੂੰ ਠੰਡਾ ਕਰ ਲਿੱਤਾ ਜਾਂਦਾ ਹੈ ਇਸ ਨਾਲ ਪਾਣੀ ਪੀਣ ਯੋਗ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਇਸ ਨਾਲ ਪਾਣੀ ਸਾਫ਼ ਸੁਥਰਾ ਸਾਰੇ ਕੀਟਾਣੂ ਮਰ ਜਾਂਦੇ ਹਨ ਤੇਅ ਇਹ ਪੀਣ ਨਾਲ ਸਰੀਰ ਵੀ ਅਰੋਗ ਰਹਿੰਦਾ ਹੈ ਇਸ ਤੋਂ ਇਲਾਵਾ ਆਪਾਂ ਪਾਣੀ ਨੂੰ ਪੁਣ ਸਕਦੇ ਹਨ ਛਾਣ ਸਕਦੇ ਹਨ ਜਾਂ ਜਿਵੇਂ ਪਾਣੀ ਸ਼ਾਣ ਕੇ ਪੀਤਾ ਹੈ ਜੋ ਕੀਟਾਣੂ ਹੋਣਗੇ ਆਪਾਂ ਉੱਤੇ ਪੋਣੀ ਦੇ ਉੱਪਰ ਆ ਜਾਂਦੇ ਹਨ ਪਾਣੀ ਸਾਫ਼ ਦਿਖਦਾ ਹੈ ਜਾਂ ਆਪਾਂ ਟੂਟੀ ਦੇ ਨਾਲ ਕੋਈ ਸੂਤੀ ਕਪੜਾ ਬੰਨ ਸਕਦੇ ਹਾਂ ਅਤੇ ਜੋ ਵੀ ਪਾਣੀ ਸਾਨੂੰ ਛਾਣ ਕੇ ਮਿਲ ਜਾਂਦਾ ਹੈ ਇਸ ਤਰ੍ਹਾਂ ਵੀ ਪਾਣੀ ਪੀਣ ਲਾਇਕ ਹੋ ਜਾਂਦਾ ਹੈ ਅਤੇ ਪਾਣੀ ਸਾਨੂੰ ਸਾਫ਼ ਮਿਲਦਾ ਹੈ ਜਾਂ ਤਰੀਕਾ ਇੱਕ ਇਹੀ ਹੁੰਦਾ ਹੈ ਕੀ ਪਾਣੀ ਨੂੰ ਪਾਣੀ ਨੂੰ ਕਿਸੇ ਵੀ ਬਰਤਨ ਵਿੱਚ ਭਰ ਕੇ ਰੱਖ ਲਓ ਉਸਦੇ ਸਾਰੇ ਕੀਟਾਣੂ ਜੋ ਕਿ ਨੀਚੇ ਥੱਲੇ ਬਹਿ ਜਾਂਦੇ ਹਨ ਅਤੇ ਫਿਰ ਉਹ ਪਾਣੀ ਥੋੜ੍ਹਾ ਉੱਪਰੋਂ ਹਲਕਾ ਲੱਗਦਾ ਹੈ ਅਤੇ ਉੱਪਰੋਂ ਪਾਣੀ ਪੀ ਲਿਆ ਜਾਂਦਾ ਹੈ ਜਾਂ ਇਸ ਤੋਂ ਇਲਾਵਾ ਸਾਨੂੰ ਮਿੱਟੀ ਦੇ ਬਰਤਨਾਂ ਵਿੱਚ ਮਿੱਟੀ ਦੇ ਘੜਿਆ ਵਿੱਚ ਸੁਰਾਈਆਂ ਵਿੱਚ ਪਾਣੀ ਨੂੰ ਰੱਖਣਾ ਚਾਹੀਦਾ ਹੈ ਇਹ ਇਸ ਨਾਲ ਪਾਣੀ ਪੀਣਯੋਗ ਹੋ ਜਾਂਦਾ ਹੈ ਪਾਣੀ ਸਾਫ਼ ਸੁਥਰਾ ਪਾਣੀ ਸਾਫ਼ ਸਵੱਛ ਜਲ ਰਹਿੰਦਾ ਹੈ ਜਾਂ ਆਪਾਂ ਪਾਣੀ ਵਿੱਚ ਕੁਝ ਨੀਮ ਦੀਆਂ ਪੱਤੀਆਂ ਨੂੰ ਪਾ ਕੇ ਰੱਖ ਸਕਦੇ ਹਨ ਫਿਰ ਉਸਨੂੰ ਛਾਣ ਲਿਆ ਜਾਂਦਾ ਹੈ ਇਸ ਤਰ੍ਹਾਂ ਪਾਣੀ ਪੀਣਯੋਗ ਸ਼ੁੱਧ ਹੋ ਜਾਂਦਾ ਹੈ ਜਾਂ ਅੱਜ ਕੱਲ੍ਹ ਆਪਾਂ ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ ਨਾਲ ਪਾਣੀ ਰੱਖਣ ਨਾਲ ਪਾਣੀ ਸਾਫ਼ ਸੁਥਰਾ ਹੋ ਜਾਂਦਾ ਹੈ ਇਸ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਸਰੀਰ ਤੰਦਰੁਸਤ ਰਹਿੰਦਾ ਹੈ ਇਹਨਾਂ ਭਾਂਡਿਆਂ ਵਿੱਚ ਪਾਣੀ ਪੀਣ ਨਾਲ ਬਿਲਕੁਲ ਵਧੀਆ ਰਹਿੰਦਾ ਸਰੀਰ ਵਾਸਤੇ ਅਰੋਗ ਸਰੀਰ ਅਰੋਗ ਰਹਿੰਦਾ ਹੈ ਇਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਨਾਲ ਆਪਾਂ ਪਾਣੀ ਨੂੰ ਸ਼ੁੱਧ ਕਰ ਸਕਦੇ ਹਾਂ ਧੰਨਵਾਦ